ਹਾਂਜੀ ਮੈਂ ਬਹੁਤ ਸੋਚਦਾ ਕਿ ਬੱਚਿਆਂ ਨੂੰ ਜਿਹੜੀ ਪੰਜਾਬੀ ਭਾਸ਼ਾ ਸਿਖਾਉਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਜਿਹੜੀ ਸਾਡੀ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਸਾਡੀ ਮਾਂ ਬੋਲੀ ਹੈ ਇਸ ਤੋਂ ਬਿਨਾ ਅਸੀਂ ਕੱਖ ਦੇ ਵੀ ਨਹੀਂ ਇਹ ਸਾਨੂੰ ਇਸਦਾ ਸਤਿਕਾਰ ਕਰਨਾ ਚਾਹੀਦਾ ਕਿਉਂ ਜੋ ਅਸੀਂ ਬਾਹਰ ਜਾਂਦੇ ਹਾਂ ਤਾਂ ਅਸ ਅਸੀਂ ਕੀ ਆਪਦੇ ਖੇਤਰ ਤੋਂ ਪਛਾਣੇ ਜਾਂਦੇ ਹਾਂ ਵੀ ਅਸੀਂ ਪੰਜਾਬ ਤੋਂ ਹਾਂ ਸਾਡੀ ਮਾਂ ਬੋਲੀ ਆ ਪੰਜਾਬੀ ਹੈ ਪੰਜਾਬ ਅਦਰ ਲੈਂਗੁਏਜ ਦੇ ਵਿੱਚ ਵੀ ਅਸੀਂ ਜਿਹੜਾ ਆਪਦੇ ਮੈਸੇਜ ਕਨਵੇ ਕਰ ਸਕਦੇ ਹਾਂ ਉਹ ਇੱਕ ਲਿਮਿਟ ਦੇ ਵਿੱਚ ਹੁੰਦਾ ਹੈਗਾ ਪਰ ਜਦੋਂ ਅਸੀਂ ਆਪਣੀ ਮਾਂ ਬੋਲੀ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਦੂਜਿਆਂ ਦੇ ਨਾਲ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ ਤਾਂ ਇਹ ਅਦਾਨ ਪ੍ਰਦਾਨ ਕਰਨ ਵਾਲੇ ਨੂੰ ਵੀ ਸੌਖਾ ਹੋ ਜਾਂਦਾ ਅਤੇ ਨਾਲ ਦੀ ਨਾਲ ਜਿਹਨੂੰ ਆਪਾਂ ਆਨ ਆਦਾਨ ਪ੍ਰਦਾਨ ਕਰ ਰਹੇ ਹੁੰਦੇ ਹਾਂ ਉਹਨਾਂ ਨੂੰ ਵੀ ਸਮਝਣਾ ਸੌਖਾ ਹੋ ਜਾਂਦਾ ਕਿਉਂਕਿ ਪੰਜਾਬੀ ਸਾਡੀ ਸਰਲ ਅਤੇ ਸੁਖਾਵੀਂ ਭਾਸ਼ਾ ਹੈ ਇਸ ਲਈ ਜਿਹੜਾ ਪੰਜਾਬੀ ਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਪਰ ਅੱਜ ਕੱਲ੍ਹ ਜਿਹੜਾ ਅੰਗਰੇਜ਼ੀ ਸਕੂਲਾਂ ਦੇ ਕਰਕੇ ਰੁਝਾਨ ਆ ਜਿਹੜਾ ਘੱਟ ਗਿਆ ਹੈ ਕਿਉਂਕਿ ਬੱਚਿਆਂ ਨੂੰ ਇੰਗਲਿਸ਼ ਦੀਆਂ ਬੁਕਸ ਹੀ ਸਟਾਰਟਿੰਗ ਤੋਂ ਲੱਗ ਜਾਂਦੀਆਂ ਨੇ ਪਰ ਫਿਰ ਵੀ ਸਾਡੀਆਂ ਸਰਕਾਰਾਂ ਸਾਡੀ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਬਹੁਤ ਵਡਮੁੱਲਾ ਯੋਗਦਾਨ ਅਦਾ ਕਰ ਰਹੀਆਂ ਨੇ ਹੁਣ ਸੀ ਬੀ ਐਸ ਈ ਸਕੂਲਾਂ ਦੇ ਵਿੱਚ ਵੀ ਪੰਜਾਬੀ ਨੂੰ ਪੜ੍ਹਾਇਆ ਜਾਂਦਾ ਹੈ ਅਤੇ ਹੁਣ ਸਟਾਰਟਿੰਗ ਤੋਂ ਹੀ ਜਿਹੜੀ ਪੰਜਾਬੀ ਆ ਉਹਨਾਂ ਨੂੰ ਐਲ ਆਏ ਦੇ ਫਸਟ ਕਲਾਸ ਤੋਂ ਹੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਬਸ ਮੈਂ ਇਹੀ ਕਹਿਣਾ ਚਾਹੂੰਗਾ ਜਿਹੜੀ ਪੰਜਾਬੀ ਭਾਸ਼ਾ ਹੈਗੀ ਹਰ ਇੱਕ ਵਿਅਕਤੀ ਨੂੰ ਸਿੱਖਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਪੰਜਾਬੀ ਨੂੰ ਭੁੱਲ ਗਏ ਤਾਂ ਅਸੀਂ ਕੱਖ ਦੇ ਵੀ ਨਹੀਂ ਹਾਂ ਪੰਜਾਬੀ ਭਾਸ਼ਾ ਦਾ ਸਿੱਖਣਾ ਸਾਡੇ ਲਈ ਬਹੁਤ ਜ਼ਰੂਰੀ ਹੈ